ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਵਿਸ਼ੇਸ਼ ਲੋੜਾਂ ਜਾਂ ਅਸਮਰਥਾਵਾਂ ਅਲਵਿਦਾ ਨੂੰ ਬਹੁਤ ਅਨੁਕੂਲਿਤ ਕਰਦੀ ਹੈ ਪੰਜਾਬ ਸਰਕਾਰ ਨੇ ਬੱਚਿਆਂ ਲਈ ਮੁਫਤ ਸਿੱਖਿਆ ਦਾ ਪੂਰਾ ਪ੍ਰਬੰਧ ਕੀਤਾ ਹੈ ਪੰਜਾਬ ਸਰਕਾਰ ਨੇ ਜਗ੍ਹਾ ਜਗ੍ਹਾ 'ਤੇ ਗੌਰਮੈਂਟ ਸਕੂਲਾਂ ਦਾ ਪ੍ਰਬੰਧ ਕਰ ਦਿੱਤਾ ਗਿਆ ਤਾਂ ਜੋ ਕੋਈ ਵੀ ਵਿਦਿਆਰਥੀ ਅਨਪੜ੍ਹ ਨਾ ਰਹਿ ਸਕਣ ਉਹਨਾਂ ਨੂੰ ਮੁਫਤ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਹੈ ਉਹਨਾਂ ਨੇ ਮੁਫਤ ਕਿਤਾਬਾਂ ਮੁਫਤ ਵਰਦੀਆਂ ਅਤੇ ਮੁਫਤ ਭੋਜਨ ਦਾ ਵੀ ਪ੍ਰਬੰਧ ਕੀਤਾ ਹੈ ਜੇ ਕੋਈ ਵਿਦਿਆਰਥੀ ਨਹੀਂ ਪੜ੍ਹ ਸਕਦਾ ਜਾਂ ਉਸਦੇ ਮਾਂ ਬਾਪ ਉਸਨੂੰ ਪੜ੍ਹਾਉਣ ਦੇ ਪੜ੍ਹਾਉਣ ਨਹੀਂ ਪੜ੍ਹਾ ਨਹੀਂ ਸਕਦੇ ਹੈ ਉਸਨੇ ਉਹਨਾਂ ਨੇ ਪੰਜਾਬ ਸਰਕਾਰ ਨੇ ਉਸ ਲਈ ਮੁਫਤ ਸਿੱਖਿਆ ਦਾ ਪ੍ਰਬੰਧ ਕੀਤਾ ਹੈ ਉਸਨੂੰ ਕਿਤਾਬਾਂ ਵਰਦੀਆਂ ਮੁਫਤ ਦੇ ਦਿੱਤੀਆਂ ਹਨ ਤਾਂ ਕਿ ਵਿਦਿਆਰਥੀ ਚੰਗੀ ਤਰਾਂ ਪੜ੍ਹ ਸਕਣ ਉਹਨਾਂ ਦੀ ਪੜ੍ਹਾਈ ਵਿੱਚ ਕੋਈ ਵੀ ਰੁਕਾਵਟ ਨਹੀਂ ਆ ਸਕੇ ਅਤੇ ਉਹ ਅੱਗੇ ਜਾ ਕੇ ਇੱਕ ਚੰਗੇ ਨਾਗਰਿਕ ਬਣ ਸਕਣ ਪੰਜਾਬ ਵਿੱਚ ਸਿੱਖਿਆ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਬਹੁਤ ਜ਼ੋਰ ਦਿੱਤਾ ਗਿਆ ਹੈ ਅੱਜ ਕੱਲ ਸਾਰੇ ਪੰਜਾ ਪੰਜਾਬ ਪੂਰੇ ਪੰਜਾਬੀ ਜਗ੍ਹਾ ਜਗ੍ਹਾ 'ਤੇ ਸਰਕਾਰੀ ਸਕੂਲ ਖੋਲ੍ਹ ਦਿੱਤੇ ਗਏ ਹਨ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਕਾਲਟ ਦਿਆਨ ਧਿਆਨ ਦਿੱਤਾ ਗਿਆ ਹੈ ਗਵਰਮੈਂਟ ਸਕੂਲਾਂ ਵਿੱਚ ਧਿਆਨ ਦਿੱਤੇ ਗਏ ਮੈਂ ਵੀ ਇੱਕ ਟੀਚਰ ਹਾਂ ਮੈਂ ਵੀ ਚਾਹੁੰਦੀ ਹਾਂ ਕਿ ਹਰ ਇੱਕ ਵਿਦਿਆਰਥੀ ਪੜ੍ਹੇ ਜੇ ਵਿਦਿਆਰਥੀ ਕੋਈ ਫੀਸ ਨਹੀਂ ਦੇ ਸਕਦਾ ਮੈਂ ਖੁਦ ਉਸਦੀ ਫੀਸ ਦੇਵਾਂਗੀ ਉਸਨੂੰ ਪ ਪੜ੍ਹਨ ਲਈ ਪ੍ਰੇਰਿਤ ਕਰਾਂਗੀ ਤਾਂ ਕੋਈ ਉਹ ਵਿਦਿਆਰਥੀ ਆਪਣੇ ਉਜਵਲ ਭਵਿਸ਼ ਦਾ ਨਿਰਮਾਣ ਕਰ ਸਕੇ